ਅੱਜ ਕੱਲ੍ਹ ਦੇ ਮੋਡਰਨ ਯੁੱਗ ਵਿੱਚ ਬੱਚੇ ਮੋਬਾਈਲ ਫ਼ੋਨ ਅਤੇ ਕੰਪਿਊਟਰਾਂ ਉੱਤੇ ਗੇਮਾਂ ਖੇਡਦੇ ਹਨ ਜਦਕਿ ਪੁਰਾਣੇ ਸਮਿਆਂ ਦੇ ਵਿੱਚ ਬੱਚੇ ਇਕੱਠੇ ਹੋ ਕੇ ਮੈਦਾਨ ਵਿੱਚ ਜਾ ਕੇ ਗੁੱਲੀ ਡੰਡਾ ਪਿੱਠੂ ਗਰਮ ਖੋ ਖੋ ਬੈਟ ਬੋਲ ਆਦਿ ਗੇਮਾਂ ਖੇਡਦੇ ਸਨ ਜਿਨ੍ਹਾਂ ਕਰਕੇ ਉਹ ਤੰਦਰੁਸਤ ਅਤੇ ਵਧੀਆ ਰਹਿੰਦੇ ਸਨ ਪਰ ਅੱਜ ਕੱਲ੍ਹ ਬੱਚੇ ਮੋਬਾਈਲ ਫ਼ੋਨਾਂ ਅਤੇ ਕੰਪਿਊਟਰਾਂ ਉੱਤੇ ਔਨਲਾਈਨ ਗੇਮਾਂ ਖੇਡਦੇ ਹਨ ਜਿਨ੍ਹਾਂ ਕਰਕੇ ਉਹ ਇੱਕੋ ਥਾਂ 'ਤੇ ਬੈਠ ਕੇ ਘੰਟਾ ਘੰਟਾ ਗੇਮਾਂ ਖੇਡਦੇ ਹਨ ਜਿਨ੍ਹਾਂ ਕਰਕੇ ਉਹਨਾਂ ਦੀ ਸਿਹਤ 'ਤੇ ਬਹੁਤ ਹੀ ਜ਼ਿਆਦਾ ਅਸਰ ਪੈਂਦਾ ਹੈ ਅਤੇ ਉਹ ਕਈ ਬਿਮਾਰੀਆਂ ਦਾ ਵੀ ਸਾਹਮਣਾ ਕਰਦੇ ਹਨ